ਮੇਰੀ ਜ਼ਿੰਦਗੀ ਦੇ ਵਿੱਚ ਕਾਫੀ ਇਹੋ ਜਿਹੇ ਪਲ ਆ ਜੋ ਯਾਦਗਾਰ ਆ ਅਤੇ ਜਿਹੜੀ ਇਹ ਗੱਲ ਸਮਝਾ ਰਹੀ ਆ ਉਹ ਦੋ ਸਾਲ ਪਹਿਲਾਂ ਦੀ ਆ ਅਤੇ ਜਿਹੜੀ ਮੇਰੇ ਘਰ ਦੇ ਮਤਲਬ ਮੈਨੂੰ ਇਹ ਕਹਿੰਦੇ ਸੀ ਵੀ ਅਸੀਂ ਨੈਣਾ ਦੇਵੀ ਜਾਣਾ ਹੈ ਅਤੇ ਨੈਣਾ ਦੇਵੀ ਜਾਣ ਨੈਣਾ ਦੇਵੀ ਜਾਣਾ ਅਤੇ ਨੈਣਾ ਦੇਵੀ ਜਾਣ ਲਈ ਅਸੀਂ ਮਤਲਬ ਟ੍ਰੇਨ ਪਹਿਲਾਂ ਅਸੀਂ ਟ੍ਰੇਨ 'ਤੇ ਗਏ ਸੀ ਉਸ ਤੋਂ ਬਾਅਦ ਅਸੀਂ ਮਤਲਬ ਬੱਸ ਫੜੀ ਅਤੇ ਜਦੋਂ ਬਸ ਫੜੀ ਉਸ ਤੋਂ ਬਾਅਦ ਨੈਣਾ ਦੇਵੀ ਜਦੋਂ ਪੁੱਜੇ ਤਾਂ ਮੈਨੂੰ ਨੀਚੇ ਖੜ੍ਹ ਕੇ ਮਤਲਬ ਬਹੁਤ ਉੱਪਰ ਦੇਖਣ 'ਚ ਕਾਫੀ ਡਰ ਲੱਗਿਆ ਕਿ ਮੈਂ ਕਿੱਦਾਂ ਜਾਉਂਗੀ ਹੈ ਨਾ ਉੱਪਰ ਉਚਾਈ ਬਹੁਤ ਆ ਪਰ ਜਦੋਂ ਮਤਲਬ ਕਿ ਮੈਂ ਹੌਲੀ ਹੌਲੀ ਜਾਣ ਲੱਗ ਗਈ ਹੈ ਨਾ ਮਤਲਬ ਕਾਫੀ ਮੁਸ਼ਕਿਲ ਨਾਲ ਮੈਂ ਸੀੜੀਆਂ ਪਾਰ ਕੀਤੀਆਂ ਆਪਣੀਆਂ ਜਦੋਂ ਮੈਂ ਸੀੜੀਆਂ ਪਾਰ ਕੀਤੀਆਂ ਤਾਂ ਮਤਲਬ ਮੇ ਜਿਹੜਾ ਮੇਰਾ ਡਰ ਸੀਗਾ ਉਹ ਮੇਰਾ ਡਰ ਹੈ ਨਾ ਮਤਲਬ ਨਿਕਲ ਗਿਆ ਜਦੋਂ ਮੈਨੂੰ ਸਭ ਤੋਂ ਉੱਪਰ ਜਾ ਕੇ ਪੁੱਜੀ ਅਤੇ ਉੱਥੇ ਜਾ ਕੇ ਤਾਂ ਮੈਂ ਵਿਊ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਮੈਂ ਫੋਟੋਆਂ ਵਗੈਰਾ ਕਲਿੱਕ ਕੀ ਕੀਤੀਆਂ ਜਿਹਦੇ ਕਰਕੇ ਮਤਲਬ ਮੈਂ ਇਹ ਚੀਜ਼ ਸਿੱਖੀ ਵੀ ਆ ਕਿ ਹਾਂ ਮਤਲਬ ਜੇ ਅਸੀਂ ਕਿਸੇ ਦਾ ਕਿਸੇ ਦੀ ਪ੍ਰਵਾਹ ਨਾ ਕਰਕੇ ਅਸੀਂ ਮਤਲਬ ਅਸੀਂ ਅੱਗੇ ਵਧ ਜਾਵਾਂਗੇ ਤਾਂ ਮਤਲਬ ਕਿਸੇ ਦੀ ਨਾ ਸੁਣਾਂਗੇ ਤਾਂ ਅੱਗੇ ਵਧ ਜਾਏ ਵਧਦੇ ਜਾਵਾਂਗੇ ਤਾਂ ਅਸੀਂ ਇੱਕ ਨਾ ਇੱਕ ਦਿਨ ਸਕਸੈਸ ਜ਼ਰੂਰ ਮਤਲਬ ਪਾ ਲੂੰਗੇ ਹੈ ਨਾ ਅਤੇ ਉਸ ਤੋਂ ਬਾਅਦ ਫਿਰ ਮੈਂ ਦੋ ਤਿੰਨ ਵਾਰ ਹੋਰ ਜਾ ਆਈ ਫਿਰ ਇਸ ਤਰ੍ਹਾਂ ਉਸ ਤੋਂ ਬਾਅਦ ਮੈਨੂੰ ਕਦੇ ਡਰ ਨਹੀਂ ਲੱਗਿਆ ਹੈਗਾ